ਪੰਜਾਬ ਸਕੂਲਾਂ ਦੀ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਸਿੱਖਿਆ ਪ੍ਰਣਾਲੀ ਬਹੁਤ ਵਧੀਆ ਢੰਗ ਨਾਲ ਅਪਣਾਈ ਜਾਂਦੀ ਹੈ ਸ ਪੰਜਾਬ ਦੇ ਸਕੂਲਾਂ ਦੇ ਵਿੱਚ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਸਮਾਰਟ ਸਕੂਲ ਖੋਲ੍ਹੇ ਗਏ ਨੇ ਇਹਨਾਂ ਸਮਾਰਟ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਪਹਿਲਾਂ ਸ ਮਤਲਬ ਕਿ ਚੌਕ ਵਾਲੇ ਬੋਰਡ 'ਤੇ ਬਲੈਕ ਬੋਰਡ ਦੇ ਉੱਪਰ ਟੀਚਰ ਮਤਲਬ ਕਿ ਲਿਖ ਕੇ ਪੜ੍ਹਾਉਂਦੇ ਸਨ ਪ੍ਰੰਤੂ ਹੁਣ ਇੱਕ ਨਵੀਂ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਪ੍ਰੋਜੈਕਟਰ ਦੁਆਰਾ ਉਹਨਾਂ ਦਾ ਸਾਰਾ ਮਤਲਬ ਕਿ ਦਿਖਾਇਆ ਜਾਂਦਾ ਹੈ ਉਹਨਾਂ ਦਾ ਪ੍ਰੋਗਰਾਮ ਚਲਾਇਆ ਜਾਂਦਾ ਹੈ ਐਜੂ ਸੈਟ ਵਗੈਰਾ ਬਣਾਏ ਨੇ ਐਂਡ ਕੰਪਿਊਟਰ ਲੈਬਸ ਵਗੈਰਾ ਅਵੇਲੇਬਲ ਕਰਵਾਈਆਂ ਗਈਆਂ ਬੱਚਿਆਂ ਨੂੰ ਜਿਸ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਸਿੱਖਣ ਨੂੰ ਮਿਲਦਾ ਹੈ ਬੱਚੇ ਕੰਪਿਊਟਰ ਸਿੱਖਦੇ ਨੇ ਬੱਚੇ ਕੰਪਿਊਟਰ ਦੇ ਵਿੱਚੋਂ ਨਵੀਂ ਟੈਕਨੋਲੋਜੀ ਦੀਆਂ ਸ ਮਤਲਬ ਕਿ ਕੋਈ ਗਤੀਵਿਧੀਆਂ ਕਰਦੇ ਹਨ ਜਿਹਨਾਂ ਦੁਆਰਾ ਉਹਨਾਂ ਦੇ ਸਿੱਖਿਆ ਪ੍ਰਣਾਲੀ ਦੇ ਵਿਕਾਸ ਵਿੱਚ ਵਾਧਾ ਹੁੰਦਾ ਹੈ ਬੱਚੇ ਕੰਪਿਊਟਰ ਦੇ ਉੱਪਰ ਟਾਈਪਿੰਗ ਸਿੱਖਦੇ ਨੇ ਬੱਚੇ ਕੰਪਿਊਟਰ ਦੇ ਵਿੱਚ ਜਿਹੜਾ ਬੇਸਿਕ ਕੰਪਿਊਟਰ ਕੋਰਸ ਹੈ ਉਹ ਵੀ ਸਾਰਾ ਕਵਰ ਕਰਦੇ ਨੇ ਅ ਆਹ ਮਾਈਕਰੋਸੋਫਟ ਐਕਸਲ ਹੋ ਗਿਆ ਐਮ ਐਸ ਵਰਡ ਹੈਗਾ ਇੱਦਾਂ ਦੇ ਇੱਦਾਂ ਇੱਦਾਂ ਦੇ ਮਤਲਬ ਕਿ ਪ੍ਰੋਗਰਾਮ ਚਲਾਉਣੇ ਬੱਚੇ ਸਿੱਖਦੇ ਨੇ ਅਤੇ ਦੂਸਰੀ ਗੱਲ ਲੈਂਗੁਏਜ ਦੀ ਜਿੱਦਾਂ ਕਿ ਪਹਿਲਾਂ ਅਸੀਂ ਗੱਲ ਕਰੀਏ ਤਾਂ ਤਾਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਪੰਜਾਬੀ ਮੀਡੀਅਮ ਦੇ ਵਿੱਚ ਹੀ ਬੱਚਿਆਂ ਨੂੰ ਹਰ ਸਬਜੈਕਟ ਪੜ੍ਹਾਇਆ ਜਾਂਦਾ ਸੀ ਪ੍ਰੰਤੂ ਹੁਣ ਦੋਨੋਂ ਮੀਡੀਅਮ ਦੇ ਵਿੱਚ ਚਾਹੇ ਬੱਚਾ ਪੰਜਾਬੀ ਮੀਡੀਆ ਦਾ ਚਾਹੇ ਇੰਗਲਿਸ਼ ਮੀਡੀਅਮ ਦਾ ਜੇਕਰ ਬੱਚਾ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਨਾ ਚਾਹੁੰਦਾ ਹੈ ਤਾਂ ਹੁਣ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਜੇਕਰ ਕੋਈ ਬੱਚਾ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਦਾ ਹੈ ਤਾਂ ਉਹਨੂੰ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਾਇਆ ਸੋ ਦੋਨੋਂ ਹੀ ਮੀਡੀਅਮ ਦੇ ਵਿੱਚ ਬੱਚਿਆਂ ਨੂੰ ਜਿਹੜਾ ਪੜ੍ਹਾਇਆ ਜਾਂਦਾ ਹੈ ਅਤੇ ਬੱਚੇ ਬਹੁਤ ਸਾਰੇ ਅ ਮਤਲਬ ਕਿ ਵਿਕਾਸ ਵੱਲ ਅਰ ਤੁਰ ਰਹੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਬੱਚੇ ਨੇ ਉਹ ਸੀ ਬੀ ਐਸ ਈ ਬੋਰਡ ਦੇ ਬੱਚਿਆਂ ਦੇ ਬਰਾਬਰ ਆ ਰਹੇ ਨੇ ਸਟੱਡੀ ਦੇ ਵਿੱਚੋਂ ਬਹੁਤ ਵਧੀਆ ਨੰਬਰ ਲੈ ਰਹੇ ਨੇ ਸੋ ਇਹ ਸਿੱਖਿਆ ਪ੍ਰਣਾਲੀ ਬਹੁਤ ਵਧੀਆ ਹੈ